ਹਾਂ ਜੀ ਸਾਡੇ ਖੇਤਰ ਵਿੱਚ ਖੇਡਾਂ ਅੱਡੀ ਟੱਪਣਾ ਖੋ ਖੋ ਐ ਰੱਸੀ ਟੱਪਣਾ ਅਤੇ ਉਹਦਾ ਨਾਮ ਕੀ ਹੈ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਭੰਡਾ ਭੰਡਾਰੀਆ ਵਿੱਚ ਮਤਲਬ ਕਿ ਇੱਕ ਜਣਾ ਬੈਠ ਜਾਂਦਾ ਹੈ ਅਤੇ ਬਾਕੀ ਲੋਕ ਉਸਦੇ ਸਿਰ 'ਤੇ ਮੁੱਕੀਆਂ ਰੱਖਦੇ ਆ ਅਤੇ ਫਿਰ ਓਸਨੂੰ ਪੁੱਛਦੇ ਆ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਹੈ ਅਤੇ ਫਿਰ ਉਹ ਬੋਲਦਾ ਹੈ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਖੋ ਖੋ ਵਿੱਚ ਮਤਲਬ ਕਿ ਟੀਮ ਹੁੰਦੀ ਹੈ ਉਹ ਬੈਠੇ ਹੁੰਦੇ ਹੈ ਦਸ ਜਣੇ ਬੈਠੇ ਹੁੰਦੇ ਹੈ ਅਤੇ ਦੋ ਜਣੇ ਭੱਜਦੇ ਹੁੰਦੇ ਹੈ ਅਤੇ ਇੱਕ ਜਣਾ ਉਸਨੂੰ ਫੜਦਾ ਹੁੰਦਾ ਤੇ ਜਿਹੜਾ ਲੰਗੜਾ ਸ਼ੇਰ ਹੁੰਦਾ ਹੈ ਉਹਦੇ ਵਿੱਚ ਬੱਚੇ ਮਤਲਬ ਕਿ ਚਾਰ ਪੰਜ ਬੱਚੇ ਭੱਜ ਰਹੇ ਹੁੰਦੇ ਇੱਕ ਬੱਚਾ ਲੰਗੜਾ ਸ਼ੇਰ ਬਣ ਕੇ ਓਸ ਨੂੰ ਫੜਦਾ ਹੁੰਦਾ